ਪੰਜਾਬ ਦਾ ਵਿਰਸਾ ਇੱਕ ਅਮੀਰ ਵਿਰਸਾ ਹੈ ਪਹਿਲਾਂ ਦੇ ਲੋਕ ਹੱਥੀਂ ਕੰਮ ਕਰਦੇ ਹੁੰਦੇ ਸੀ ਹੱਥ ਦੱਸੀਂ ਕੰਮ ਕਰਨਾ ਅਤੇ ਬਹੁਤ ਚੰਗਾ ਸਮਝਦੇ ਸੀਗੇ ਹੁਣ ਤਾਂ ਮਸ਼ੀਨਾਂ 'ਤੇ ਕੰਮ ਹੁੰਦੇ ਆ ਮਸ਼ੀਨਾਂ 'ਤੇ ਸਭ ਕੰਮ ਕਰਕੇ ਅਤੇ ਫਿਰ ਹੀ ਠੀਕ ਰਹਿੰਦੇ ਅਤੇ ਅੱਗੇ ਬੁਣਾਈ ਦਾ ਸ਼ਿਕੰਜਾ ਖੱਦਰ ਖੱਦਰ ਬੁਣਨਾ ਖੱਡੀਆਂ ਦੇ ਅਤੇ ਚਰਖਾ ਕੱਤਣਾ ਮੰਜੇ ਬੁਣਨਾ ਸਿਲਾਈਆਂ ਬੁਣਨੀਆਂ ਸੂਟ ਸਿਆਉਣੇ ਦਰੀਆਂ ਬੁਣਨੀਆਂ ਪੱਖੀਆਂ ਬੁਣਨੀਆਂ ਫੁਲਕਾਰੀ ਕੱਢਣੀ ਬਾਗ ਕੱਢਣਾ ਇਹ ਬਹੁਤ ਕੰਮ ਕੀਤੇ ਅੱਗੇ ਹੁਣ ਤਾਂ ਅੱਜ ਕੱਲ੍ਹ ਇਹਨਾਂ ਚੀਜ਼ਾਂ ਨੂੰ ਕੋਈ ਪਸੰਦ ਨਹੀਂ ਕਰਦਾ ਪਰ ਫਿਰ ਵੀ ਆਪਦਾ ਜਿਹੜਾ ਪੰਜਾਬੀ ਵਿਰਸਾ ਸਾਨੂੰ ਸੰਭਾਲਣਾ ਚਾਹੀਦਾ ਕਿਉਂਕਿ ਬਹੁਤ ਸੋਹਣਾ ਚੰਗਾ ਲੱਗਦਾ ਸੀਗਾ ਹੁਣ ਚੰਗਾ ਹੁਣ ਵੀ ਹੁਣ ਇਸ ਕੰਮ ਇਹਨਾਂ ਕੰਮਾਂ ਨੂੰ ਅੱਜ ਕੱਲ੍ਹ ਦੇ ਜਿਹੜੇ ਨਵੀਂ ਪਨੀਰੀ ਆ ਪਸੰਦ ਨਹੀਂ ਕਰਦੀ ਗੀ ਪਰ ਜਿਹੜੇ ਜਿਹੜੇ ਲੋਕ ਆਪਣੇ ਘਰ ਦੇ ਬਣੇ ਕੱਪੜੇ ਲੀੜੇ ਪਾਉਂਦੇ ਸਵਾਉਂਦੇ ਉਹ ਤਾਂ ਪਾਉਂਦੇ ਹੀ ਉਹਨਾਂ ਉਹ ਬ ਉਹ ਬਜ਼ਾਰੀ ਨਹੀਂ ਪਸੰਦ ਕਰਦੇ ਫਿਰ ਵੀ ਇਸੇ ਚੀਜ਼ ਨੂੰ ਹੀ ਪਹਿਲ ਦਿੰਦੇ ਆ ਕਿ ਆਪਦਾ ਘਰ ਬਣਾ ਕੇ ਆਪਦਾ ਘਰ ਬਣਾ ਕੇ ਹੀ ਵਰਤੀਏ ਅਤੇ ਕਈ ਹੁਣ ਜਿਹੜੇ ਅੱਜ ਕੱਲ੍ਹ ਦੀ ਪਨੀਰੀ ਉਹ ਨਹੀਂ ਪਸੰਦ ਕਰਦੀ ਰੈਡੀਮੇਟ ਕੰਮ ਚੱਲ ਪਿਆ ਵੈ ਰੈਡੀਮੇਟ ਹੀ ਇਹਨਾਂ ਨੇ ਬਣਾਉਣਾ ਪਾਉਣਾ ਅਤੇ ਉਹ ਵੀ ਜ਼ਮਾਨਾ ਸੀਗਾ ਵੀ ਜਦੋਂ ਲੋਕ ਸਾਰਾ ਕੁਝ ਆਪਦੇ ਹੱਥੀਂ ਕਰਕੇ ਹੱਥੀਂ ਬਣਾ ਕੇ ਖਾਂਦੇ ਅਤੇ ਪਾਉਂਦੇ ਸੀ ਮਿਹਨਤ ਕਰਦੇ ਸੀਗੇ ਅਤੇ ਬਹੁਤ ਖੁਸ਼ ਸੀ ਮੈਂ ਤਾਂ ਆਪ ਬਹੁਤ ਕੰਮ ਕੀਤਾ ਹੱਥ ਸਿਲਾਈਆਂ ਬੁਣਨੀਆਂ ਮਸ਼ੀਨ ਚਲਾਉਣੀ ਕੱਪੜਾ ਲੀੜਾ ਘਰ ਸਿਉਂ ਕੇ ਘਰਦਾ ਸਿਉਂਤਾ ਹੀ ਪਾਈਦਾ ਸੀ ਅਤੇ ਹੁਣ ਬਸ ਸਰੀਰ ਰਹਿ ਗਿਆ ਹੁਣ ਨਹੀਂ ਕੀਤਾ ਜਾਂਦਾ ਪਰ ਫਿਰ ਵੀ ਉਹ ਚੀਜ਼ਾਂ ਚੰਗੀਆਂ ਲੱਗਦੀਆਂ ਵੇਲੇ ਚੰਗੇ ਸੀ ਅੱਜ ਅੱਜ ਦੇ ਵੇਲੇ ਨਾਲੋਂ ਉਹ ਵੇਲਾ ਬਹੁਤ ਚੰਗਾ ਸੀ ਕਿਉਂਕਿ ਜਨਾਨੀਆਂ ਘਰ ਬੈਠੀਆਂ ਸਾਰੇ ਕੰਮ ਕਰੀ ਜਾਂਦੀਆਂ ਸੀ ਅੰਦਰ ਹੀ ਅੰਦਰ ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗਦਾ ਹੁਣ ਤਾਂ ਕੋਈ ਜ ਮਾ ਪਤਾ ਨਹੀਂ ਲੱਗਦਾ